ਹੈਲੋ ਨਮਸਕਾਰ ਜੀ ਹਾਂਜੀ ਗੁਪਾਲ ਜੀ ਤੁਸੀਂ ਇੱਦਾਂ ਕਰ ਸਕਦੇ ਤੁਸੀਂ ਇਸ ਤਰ੍ਹਾਂ ਕਰੋ ਦੇਖੋ ਸਭ ਤੋਂ ਅੱਛਾ ਤਾਂ ਹੈ ਤੁਸੀਂ ਆਪਣੀ ਅੱਗੇ ਆ ਜਿਹੜੇ ਆਪਣੇ ਪਬਲਿਕ ਸੈਕਟਰ ਦੇ ਇਗਜ਼ਾਮ ਹੁੰਦੇ ਨੇ ਤੁਸੀਂ ਉਹਨਾਂ ਦੀ ਤਿਆਰੀ ਕਰੋ ਤੁਸੀਂ ਅੱਛੇ ਇਗਜ਼ਾਮ ਕਲੀਅਰ ਕਰਕੇ ਜਿੱਦਾਂ ਆਪਣੇ ਬੀ ਐੱਚ ਈ ਐੱਲ ਹੋ ਗਈ ਐੱਨ ਟੀ ਪੀ ਸੀ ਹੋ ਗਈ ਆਪਣੀ ਐੱਨ ਐੱਚ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਹੋ ਗਈ ਤੁਸੀਂ ਇਹਨਾਂ ਟੈਸਟਾਂ ਦੀ ਤਿਆਰੀ ਕਰ ਸਕਦੇ ਹੋ ਉਸ ਤੋਂ ਬਿਨਾਂ ਵਾਵਾ ਟੋਪਿਕ ਸ ਸੈਂਟਰ ਹੈ ਠੀਕ ਹੈ ਜੀ ਤੁਸੀਂ ਡੀ ਆਰ ਡੀ ਓ ਹੋ ਗਿਆ ਤੁਸੀਂ ਉਹਨਾਂ ਟੈਸਟਾਂ ਦੀ ਤਿਆਰੀ ਕਰੋ ਉਹ 'ਚ ਬੜਾ ਹੀ ਅੱਛਾ ਸਕੋਪ ਹੈ ਬਹੁਤ ਹੀ ਅੱਛੀ ਲਾਈਫ ਹੁੰਦੀ ਹੈ ਇਹਨਾਂ ਦੀ ਬਹੁਤ ਸਿੱਖਣ ਨੂੰ ਮਿਲਦਾ ਹੈ ਹਾਂਜੀ ਅੱਛਾ ਤੁਸੀਂ ਜੇ ਤੁਸੀਂ ਕਦੇ ਤੁਸੀਂ ਇੱਦਾਂ ਕਰ ਸਕਦੇ ਹੋ ਜਿਵੇਂ ਤੁਸੀਂ ਇੱਥੇ ਆਪਣੇ ਜੇ ਪੰਜਾਬ 'ਚ ਹੀ ਰਹਿਣਾ ਤਾਂ ਲੁਧਿਆਣੇ ਇੰਡਸਟਰੀ ਹੈਗੀ ਹੈ ਤੁਹਾਡੀ ਸਾਈਕਲ ਇੰਡਸਟਰੀ ਹੈਗੀ ਆ ਲੁਧਿਆਣੇ ਦੇ ਵਿੱਚ ਕਾਫੀ ਹੋਰ ਤੁਹਾਡੀ ਆਪਣੀ ਮਸ਼ੀਨ ਹੈਂਡ ਟੂਲਜ਼ ਮਸ਼ੀਨ ਮਸ਼ੀਨਰੀ ਦੀ ਇੰਡਸਟਰੀ ਹੈਗੀ ਹੈ ਤੁਸੀਂ ਉੱਥੇ ਵੀ ਟਰਾਈ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਡਾ ਉੱਧਰ ਵੀ ਅੱਛਾ ਸਕੋਪ ਹੈ ਜਾਂ ਤੁਸੀਂ ਜਲੰਧਰ ਇੱਥੇ ਤੁਹਾਡੇ ਕਪੂਰਥਲਾ ਦੇ ਤੁਸੀਂ ਰਹਿਣ ਵਾਲੇ ਹੋ ਤਾਂ ਜਲੰਧਰ ਦੇ ਤੁਹਾਡੇ ਲਾਗੇ ਹੀ ਆ ਇੱਥੇ ਤੁਹਾਡੇ ਲੈਦਰ ਇੰਡਸਟਰੀ ਹੈਗੀ ਹੈ ਕਾਫੀ ਜ਼ਿਆਦਾ ਸਪੋਰਟਸ ਇੰਡਸਟਰੀ ਹੈ ਤੁਸੀਂ ਉੱਥੇ ਵੀ ਆਪਣਾ ਰੈਜੂਮੇ ਦੇ ਸਕਦੇ ਹੋ ਉੱਥੇ ਟਰਾਈ ਕਰ ਸਕਦੇ ਹੋ ਜੇ ਉੱਥੇ ਕੀ ਹੈ ਜੋਬ ਅਪੋਰਚੂਨਿਟੀ ਨਿਕਲਦੀ ਹੈ ਤਾਂ ਤੁਸੀਂ